ਹੈਲੋ ਹਾਂਜੀ ਹਾਂ ਹਾਂ ਹਾਂ ਮੈਡਮ ਜੀ ਤੁਸੀਂ ਕੋਲੇਜ ਤੋਂ ਬੋਲਦੇ ਹੋ ਹਾਂ ਬੀਐੱਸਸੀ ਹਾਂ ਹਾਂ ਹਾਂ ਪੇਪਰ ਤੁਹਾਨੂੰ ਦੇਣੇ ਆ ਐਡਮਿਟ ਕਾਰਡ ਵੀ ਚਾਹੀਦਾ ਮੈਡਮ ਅਤੇ ਅਟੈਂਡੈਂਸ ਜਿਹੜੀ ਘੱਟ ਉਹ ਦਰਅਸਲ ਗੱਲ ਇੱਦਾਂ ਸੀਗੀ ਵੀ ਮਤਲਬ ਫਾਦਰ ਸਾਹਿਬ ਥੋੜ੍ਹੇ ਜਿਹੇ ਨਾ ਢਿੱਲੇ ਮੱਠੇ ਰਹਿੰਦੇ ਸੀ ਅਤੇ ਉਹਨਾਂ ਨੂੰ ਅਟੈਂਡ ਕਰਨ ਲਈ ਫਿਰ ਦਵਾਈ ਦਵੁਈ ਦਵਾਉਣੀ ਪੈਂਦੀ ਆ ਅਤੇ ਹੋਰ ਸੱਜੇ ਖੱਬੇ ਜਾਣਾ ਪੈਂਦਾ ਹਾਂ ਇਨਫੋਰਮ ਤਾਂ ਕਰਨਾ ਸੀਗਾ ਅਤੇ ਉਹ ਦਰਅਸਲ ਨਾ ਠੰਡ ਠੁੰਡ ਦਾ ਮੌਸਮ ਸੀਗਾ ਨਾ ਦੂਰ ਪਿੰਡ ਵੀ ਕਾਫ਼ੀ ਦੂਰ ਹੈ ਮੇਰਾ ਸਕੂਟਰ ਵੀ ਥੋੜ੍ਹਾ ਖ਼ਰਾਬ ਸੀਗਾ ਅਤੇ ਮੈਂ ਸਕੂਟਰ ਮਤਲਬ ਮਕੈਨਿਕ ਨੂੰ ਕਿਹਾ ਸੀਗਾ ਠੀਕ ਕਰਕੇ ਜਲਦੀ ਦੇ ਦਿਓ ਅਤੇ ਉਹ ਹੁਣ ਦਰਅਸਲ ਇਹੀ ਪ੍ਰੋਬਲਮ ਆ ਬਾਕੀ ਤਾਂ ਚਲੋ ਬੀਹੇਵ ਵੀ ਠੀਕ ਹੋ ਜਾਏਗਾ ਅਤੇ ਹੁਣ ਐਡਮਿਟ ਕਾਰਡ ਵੀ ਚਾਹੀਦਾ ਇਸ ਕਰਕੇ ਮਤਲਬ ਮੈਂ ਐਪਲੀਕੇਸ਼ਨ ਹਾਂ ਹਾਂ ਠੀਕ ਹੈ ਠੀਕ ਮੈਂ ਠੀਕ ਮੈਂ ਨਾ ਐਪਲੀਕੇਸ਼ਨ ਲਿਖ ਕੇ ਅਤੇ ਮਤਲਬ ਜੇ ਹਮ ਠੀਕ ਠੀਕ ਓਕੇ ਓਕੇ ਓਕੇ ਠੀਕ